ਹਾਂਜੀ ਇੱਕ ਵਾਰ ਜਦੋਂ ਮੈਂ ਛੋਟੀ ਸੀ ਤਾਂ ਸਾਡੇ ਪਿੰਡ ਵਿੱਚ ਪਾਣੀ ਦੀ ਬਹੁਤ ਹੀ ਘਾਟ ਆ ਗਈ ਜਿਸ ਕਾਰਨ ਫਸਲਾਂ ਨੂੰ ਬਹੁਤ ਹੀ ਨੁਕਸਾਨ ਹੋ ਗਿਆ ਫਸਲਾਂ ਨੂੰ ਪੂਰਾ ਪਾਣੀ ਨਾ ਹੋਣ ਕਰਕੇ ਕਈ ਲੋਕਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਅਤੇ ਕਈ ਘਰਾਂ ਦੇ ਵਿੱਚ ਵੀ ਕਈ ਪਾਣੀ ਦੀ ਕਮੀ ਹੋਣ ਕਰਕੇ ਬੱਚਿਆਂ ਨੂੰ ਸਾ ਪਿੰਡ ਦਿਆਂ ਨੂੰ ਪੂਰੇ ਪਿੰਡ ਦਿਆਂ ਨੂੰ ਬਹੁਤ ਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਪਾਣੀ ਸਾਡੀ ਜ਼ਿੰਦਗੀ ਦਾ ਮੇ ਪ੍ਰੋਪਰ ਸਾਧਨ ਆ ਕਿ ਤਾਂ ਜੋ ਸਾਨੂੰ ਮਤਲਬ ਕਿ ਪਾਣੀ ਤੋਂ ਬਗੈਰ ਅਸੀਂ ਜੀਅ ਨਹੀਂ ਸਕਦੇ ਪਾਣੀ ਸਾਡੇ ਜੀਵਨ ਦਾ ਬਹਮੁੱਲਾ ਸਰੋਤ ਆ ਜਿਹਦੇ ਨਾਲ ਮਤਲਬ ਕਿ ਹਰੇਕ ਕੋਈ ਜਿਊਂਦਾ ਆ ਪਾਣੀ ਦੀ ਕਮੀ ਹੋਣ ਕਰਕੇ ਹੀ ਸਾਰਾ ਪਿੰਡ ਮਤਲਬ ਇੰਨੀ ਪਰੇਸ਼ਾਨੀ ਦੇ ਵਿੱਚ ਹੋ ਗਿਆ ਕਿ ਘਰ ਤੋਂ ਦੂਰ ਜਾ ਕੇ ਪਾਣੀ ਲਿਆਉਣਾ ਬਹੁਤ ਹੀ ਔਖਾ ਸੀ ਘਰ ਇੱਕ ਪਿੰਡ ਤੋਂ ਦੂਸਰੇ ਪਿੰਡ ਤੱਕ ਪਾਣੀ ਲਿਆਉਣਾ ਔਖਾ ਸੀ ਇਸ ਕਰਕੇ ਸਾਡੇ ਪਿੰਡ ਨੂੰ ਬਹੁਤ ਹੀ ਮੁਸੀਬਤ ਝੱਲਣੀ ਪਈ ਪਿੰਡ ਇਸ ਦਾ ਜ਼ਿੰਦਗੀ 'ਤੇ ਬਹੁਤ ਹੀ ਬੁਰਾ ਅਸਰ ਪਿਆ ਜਿਹਦੇ ਨਾਲ ਸਾਡੇ ਸਾਡੇ ਪਿੰਡ ਦੇ ਕਈ ਲੋਕਾਂ ਦਾ ਬਹੁਤ ਹੀ ਨੁਕਸਾਨ ਹੋਇਆ ਧੰਨਵਾਦ